ਤਕਨਾਲੋਜੀ ਨੇ ਨਿਊਜ ਇੰਡਸਟਰੀ ਨੂੰ ਬਹੁਤ ਸਹਾਇਤਾ ਦਿੱਤੀ ਹੈ ਅੱਜ ਕੱਲ੍ਹ ਅਸੀਂ ਦੇਖੀਏ ਤਾਂ ਅਖਬਾਰਾਂ ਨੂੰ ਘੱਟ ਲੋਕ ਫੋਨਾਂ ਉੱਤੇ 'ਤੇ ਕੰਪਿਊਟਰਾਂ ਉੱਤੇ ਖਬਰਾਂ ਨੂੰ ਜ਼ਿਆਦਾ ਦੇਖਣਾ ਪਸੰਦ ਕਰਦੇ ਹਨ ਟੀ ਵੀ ਤੋਂ ਹਟ ਕੇ ਲੋਕ ਯੂਟਿਊਬ ਦੇ ਉੱਤੇ ਜਾਂ ਹੋਰ ਜਿਹੜੇ ਨਿਊਜ ਚੈਨਲ ਨੇ ਉਨ੍ਹਾਂ ਨੇ ਆਪਣੇ ਕੰਪਿਊਟਰਾਂ ਉੱਤੇ ਫੋਨਾਂ ਉੱਤੇ ਆਪਣੇ ਵੱਖ ਵੱਖ ਰੇਡੀਓ ਫ੍ਰੀਕੂਐਂਸੀ ਦੇ ਚੈਨਲ ਖੋਲ਼੍ਹ ਲਏ ਨੇ ਜਿਨ੍ਹਾਂ ਨਾਲ ਲੋਕ ਲੋਕ ਉਨ੍ਹਾਂ ਨੂੰ ਸੁਣ ਪਾਉਂਦੇ ਨੇ ਦੇਖ ਪਾਉਂਦੇ ਅਤੇ ਜਿਸ ਇਨ੍ਹਾਂ ਸਾਰੇ ਟੈਕਨੋਲਜੀ ਦੇ ਨਾਲ ਜਿਹੜੀ ਨਿਊਜ ਇੰਡਸਟਰੀ ਹੈ ਇਹਦੇ ਵਿੱਚ ਬਹੁਤ ਵਾਧਾ ਹੋਇਆ ਹੈ ਅੱਜ ਕੱਲ੍ਹ ਜੇ ਅਸੀਂ ਦੇਖੀਏ ਤਾਂ ਜਿਹੜੇ ਛੋਟੇ ਛੋਟੇ ਜਿਹੜੇ ਆਪਣੇ ਜਰਨਲਿਸਟ ਨੇ ਜਿਹੜੇ ਨਵੇਂ ਨਵੇਂ ਜਿਨ੍ਹਾਂ ਨੂੰ ਸ਼ੌਕ ਹੁੰਦਾ ਹੈ ਉਹ ਆਪਣਾ ਚੈਨਲ ਬਣਾ ਸਕਦੇ ਨੇ ਆਪਣਾ ਚੈਨਲ ਬਣਾ ਕੇ ਉਹ ਖਬਰਾਂ ਜਿਹੜੀ ਹੈਗੀਆਂ ਨੇ ਉਹ ਇੱਕ ਲੋਕਲ ਏਰੀਏ ਦੀ ਉਨ੍ਹਾਂ ਨੂੰ ਵੀ ਬਰੋਡਕਾਸਟ ਕਰ ਸਕਦੇ ਨੇ ਮੈਂ ਆਪ ਦੀ ਜੇ ਗੱਲ ਕਰਾਂ ਤਾਂ ਮੈਂ ਆਪਣੇ ਜਿੰਨੀਆਂ ਵੀ ਖਬਰਾਂ ਨੇ ਆਪਣੇ ਲੋਕਲ ਏਰੀਆ ਦੀ ਆਪਣੇ ਦੇਸ਼ ਦੀ ਵਿਦੇਸ਼ ਦੀ ਇਹ ਸਾਰੀਆਂ ਖਬਰਾਂ ਆਪਣੇ ਫੋਨ 'ਤੇ ਦੇਖਦਾ ਹਾਂ ਸੁਣਦਾ ਹਾਂ ਜ਼ਿਆਦਾਤਰ ਮੈਂ ਦਾ ਟ੍ਰਿਬਿਊਨ ਦਾ ਹਿੰਦੋਸਤਾਨ ਟਾਈਮਸ ਵਰਗੇ ਨਿਊਜ ਅਖਬਾਰਾਂ ਜਿਹੜੇ ਅੱਜ ਕੱਲ੍ਹ ਆਨਲਾਈਨ ਵੀ ਮਿਲ ਜਾਂਦੇ ਹਨ ਇਨ੍ਹਾਂ ਨੂੰ ਹੀ ਦੇਖਦਾ ਹਾਂ